ਕਿਸਾਨਾਂ ਨੂੰ ਨਵੇਂ ਨਵੇਂ ਤਰ੍ਹਾਂ ਤਰ੍ਹਾਂ ਦੇ ਸਕੀਮਾਂ ਦਿੱਤੀਆਂ ਗਈਆਂ ਹਨ ਪੰਜਾਬ ਖੇਤੀਬਾੜੀ ਵਿਭਿੰਨਤਾ ਉਤਸ਼ਾਹ ਪ੍ਰੋਜੈਕਟ ਤੇ ਤਹਿਤ ਕਿਸਾਨਾਂ ਨੂੰ ਸਹਾਇਕ ਰਕਮ ਦਿੱਤੀ ਗਈ ਹੈ ਜਾਂ ਨਹੀਂ ਇਸ ਬਾਰੇ ਹਜੇ ਚੰਗੀ ਤਰ੍ਹਾਂ ਪੁਸ਼ਟੀ ਨਹੀਂ ਕੀਤੀ ਗਈ ਹੈ ਕਿਸਾਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਉਪਕਰਣ ਦਿੱਤੇ ਗਏ ਹਨ ਜਿਸ ਬਾਰੇ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਤੁਸੀਂ ਇਹਨਾਂ ਦੀ ਵਰਤੋਂ ਕਰੋ ਹੁਣ ਉਹਨਾਂ ਨੂੰ ਪੈਸੇ ਦਿੱਤੇ ਜਾ ਰਹੇ ਹਨ ਜਾਂ ਨਹੀਂ ਦਿੱਤੇ ਜਾ ਰਹੇ ਹਨ ਇਹਨਾਂ ਦੀ ਪੁਸ਼ਟੀ ਹਜੇ ਤੱਕ ਨਹੀਂ ਦਿੱਤੀ ਗਈ ਹੈ ਪੰਜਾਬ ਖੇਤੀਬਾੜੀ ਵਿਭਿੰਨਤਾ ਦੇ ਉਤਸ਼ਾਹ ਦੇ ਪ੍ਰੋਰੋਜੈਕਟ ਨੂੰ ਹਰ ਤਰ੍ਹਾਂ ਦੇ ਨਵੇਂ ਨਵੇਂ ਉਪਕਰਣ ਵੀ ਦਿੱਤੇ ਗਏ ਹਨ ਤਰ੍ਹਾਂ ਤਰ੍ਹਾਂ ਦਾ ਹੋਰ ਸਮਾਨ ਵੀ ਖੇਤੀਬਾੜੀ ਲਈ ਦਿੱਤਾ ਗਿਆ ਹੈ ਜਿਸ ਦੀ ਵਰਤੋਂ ਕੀਤੀ ਜਾ ਸਕੇ ਅਤੇ ਤਰ੍ਹਾਂ ਤਰ੍ਹਾਂ ਦਾ ਖੇਤੀ ਕੀਤੀ ਜਾ ਸਕੇ ਇਸ ਨੂੰ ਤਰ੍ਹਾਂ ਤਰ੍ਹਾਂ ਦੇ ਪ੍ਰੋਜੈਕਟ ਹੋਰ ਨਵੇਂ ਵੀ ਦਿੱਤੇ ਗਏ ਹਨ ਪੰਜਾਬ ਖੇਤੀਬਾੜੀ ਵਿਭਿੰਨਤਾ ਉਤਸ਼ਾਹ ਪ੍ਰੋਜੈਕਟ ਤਹਿਤ ਕਿਸਾਨਾਂ ਨੂੰ ਸਤਾ ਸਹਾਇਕ ਰਕਮ ਦਿੱਤੀ ਜਾਣੀ ਚਾਹੀਦੀ ਹੈ ਜਿਸ ਨਾਲ ਉਹਨਾਂ ਨੂੰ ਆਪਣੇ ਤਰ੍ਹਾਂ ਤਰ੍ਹਾਂ ਦੇ ਖੇਤੀ ਕਰਨ ਦੇ ਨਵੇਂ ਨਵੇਂ ਰੁਜ਼ਗਾਰ ਵੀ ਮਿਲਣ ਅਤੇ ਨਵੇਂ ਨਵੇਂ ਹੋਰ ਪੈਸੇ ਮਿਲਣ ਜਿਸ ਦੇ ਨਾਲ ਉਹ ਅੱਗੇ ਵਧਣ ਅਤੇ ਆਪਣਾ ਹੋਰ ਅੱਗੇ ਤਰੱਕੀ ਕਰਨ ਸਰਕਾਰ ਨੂੰ ਇਸ ਦਾ ਪੂਰਾ ਪੂਰਾ ਧਿਆਨ ਦੇਣਾ ਚਾਹੀਦਾ ਹੈ ਅਤੇ ਪੂਰਾ ਪੂਰਾ ਸਪੋਟ ਵੀ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਨਾਲ ਕਿਸਾਨ ਅੱਗੇ ਵਧਣ ਅਤੇ ਇਸ ਦੀ ਪੂਰੀ ਤਰ੍ਹਾਂ ਵਰਤੋਂ ਕਰਨ ਧੰਨਵਾਦ